ਪੰਜਾਬੀ ਲੋਕ ਆਪਣੀਆਂ ਸੱਭਿਆਚਾਰਿਕ ਪਰੰਪਰਾਵਾਂ ਨੂੰ ਮਨਾਉਣ ਵਾਸਤੇ ਬਹੁਤ ਸਾਰੇ ਤਿਉਹਾਰ ਮੇਲੇ ਮਨਾਉਂਦੇ ਹਨ ਅਤੇ ਹਰ ਸਾਲ ਬਾਅਦ ਜਦੋਂ ਉਹ ਤਿਉਹਾਰ ਜਾਂ ਮੇਲੇ ਮਨਾਏ ਜਾਂਦੇ ਹਨ ਉਦੋਂ ਉਹ ਆਪਣੀਆਂ ਰਵਾਇਤਾਂ ਨੂੰ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਵਿੱਚ ਪੁਰਾਣੀਆਂ ਜਿਹੜੀਆਂ ਬੋਲੀਆਂ ਗਿੱਧੇ ਭੰਗੜੇ ਦੇ ਗੀਤ ਵਿਆਹ ਦੇ ਸਮੇਂ ਦੀਆਂ ਰਸਮਾਂ ਬਹੁਤ ਸਾਰੇ ਮੌਕਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਨਾਲ ਪੰਜਾਬੀ ਭਾਸ਼ਾ ਦੀ ਉਹ ਵਰਤੋਂ ਕਰਦੇ ਹਨ ਆਪਣੀ ਮਾਤ ਬੋਲੀ ਨੂੰ ਸਨਮਾਨ ਦਿੰਦੇ ਹਨ ਉਹ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਇਹਨਾਂ ਤੋਂ ਇਲਾਵਾ ਧਾਰਮਿਕ ਪੁਰਬ ਵੱਖ ਵੱਖ ਧਰਮਾਂ ਦੇ ਜੋ ਪੰਜਾਬ ਵਿੱਚ ਲੋਕ ਰਹਿੰਦੇ ਹਨ ਉਹ ਮਨਾਉਂਦੇ ਹਨ ਅਤੇ ਦਿਵਾਲੀ ਸਾਰੇ ਪੰਜਾਬ ਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕਾਂ ਵੱਲੋਂ ਮਨਾਈ ਜਾਂਦੀ ਹੈ ਅੰਮ੍ਰਿਤਸਰ ਦੀ ਦਿਵਾਲੀ ਬਹੁਤ ਪ੍ਰਸਿੱਧ ਹੈ ਅਤੇ ਇੱਥੇ ਸਿੱਖਾਂ ਦਾ ਭਾਰੀ ਜੋੜ ਮੇਲਾ ਹੁੰਦਾ ਹੈ ਇਸ ਤੋਂ ਇਲਾਵਾ ਹੋਲੇ ਮਹੱਲੇ ਦੇ ਹੋਲੀਆਂ ਹੋਰ ਅਨੇਕਾਂ ਹੀ ਤਿਉਹਾਰ ਪੰਜਾਬ ਦੇ ਵਿੱਚ ਮਨਾਏ ਜਾਂਦੇ ਹਨ ਜਿਹਦੇ ਨਾਲ ਜਦੋਂ ਉਹਨਾਂ ਨੂੰ ਮਨਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਪੰਜਾਬੀ ਰਵਾਇਤਾਂ ਦੀਆਂ ਚੀਜ਼ਾਂ ਨੂੰ ਸਾਂਭਿਆ ਜਾਂਦਾ ਹੈ ਬੋਲੀ ਨੂੰ ਸਾਂਭਿਆ ਜਾਂਦਾ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ